ਸਿੱਖ ਧਰਮ ਦੇ ਵਿਕਾਸ ਅਤੇ ਬਦਲਾਅ ਦਾ ਇਤਿਹਾਸ ਬਹੁਤ ਵਿਸਥਾਰਿਤ ਹੈ ਇਸ ਧਰਮ ਨੂੰ ਗੁਰੂ ਨਾਨਕ ਦੇਵ ਜੀ ਦੇ ਸਮੇਂ 'ਤੇ ਆਰੰਭ ਹੋਇਆ ਸੀਗਾ ਸਮੇਂ 'ਤੇ ਆਰੰਭ ਹੋਇਆ ਸੀ ਸਿੱਖ ਧਰਮ ਦਾ ਮੂਲ ਉਦੇਸ਼ ਇੱਕ ਉੱਚੇ ਅਤੇ ਸਮਾਜਿਕ ਨਿਰਮਾਣ ਅਤੇ ਇਨਸਾਨੀ ਜੀਵਨ ਵਿੱਚ ਸਿਰਫ ਇੱਕ ਨਿਰਮਲ ਜੀਵਨ ਦੀ ਸੱਚੀ ਸੁੱਖ ਸ਼ਾਂਤੀ ਦੀ ਪ੍ਰਾਪਤੀ ਹੈ ਇਸ ਧਰਮ ਦਾ ਵਿਕਾਸ ਗੁਰੂ ਅਰਜਨ ਦੇਵ ਜੀ ਦੇ ਪ੍ਰਸਤਾਵਾਂ ਅਤੇ ਸਿੱਖ ਸੰਗਤ ਵਿੱਚ ਅੰ ਅੰਦਰਲੇ ਸੰਸਕਾਰਾਂ ਦੀ ਸਿੱਖਿਆ ਨਾਲ ਹੋਇਆ ਇਸ ਵਿੱਚ ਗੁਰੂ ਅਰਜਨ ਦੇਵ ਜੀ ਦੇ ਕਿਰਿਆਤਮਿਕ ਯੋਜਨਾਵਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਸੀ ਉਹ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਸਰੂਪ ਦੇਖਣ ਦਾ ਅਵਸਰ ਦਿੱਤਾ ਅਤੇ ਧਰਮੀ ਸਿੱਖਿਆ ਅਤੇ ਸਿੱਖੀ ਦੇ ਮੌਲਿਕ ਸਿੱਖਿਆ ਕਰਨ ਦੀ ਸਥਾਪਨਾ ਕੀਤੀ ਇਸ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਜਾਣ ਲੱਗਾ ਇਹ ਧਰਮ ਇੱਕ ਸੰਗ੍ਰਹਿਤ ਗਿਆਨ ਧਿਆਨ ਅਤੇ ਸਿੱਖਿਆ ਦੇ ਸਰੋਤ ਪੂ ਸਰੋਤ ਦੇ ਰੂਪ ਵਿੱਚ ਵਿਕਸਤ ਹੋਇਆ ਸਿੱਖ ਧਰਮ ਵਿੱਚ ਸਮਰੂਪ ਧਾਰਨਾ ਅਤੇ ਸਮਰੂਪ ਸਮਾਜ ਦੇ ਵਿਕਾਸ ਦਾ ਉਦੋਂ ਤੋਂ ਹੀ ਮਨ ਮੰਨਿਆ ਜਾਣਾ ਸੀ ਇਸ ਨੇ ਸਿੱਖ ਸਮਾਜ ਨੂੰ ਅੱਗੇ ਵਧਣ ਵਿੱਚ ਮਦਦ ਕੀਤੀ ਇਸ ਤਰ੍ਹਾਂ ਸਿੱਖ ਧਰਮ ਵਿੱਚ ਨਿੱਤ ਨਵਾਂ ਪੰਥ ਅਤੇ ਸੇਵਾ ਦੀ ਭਾਵਨਾ ਅਤੇ ਸਾਧੂ ਜੀਵਨ ਵਿੱਚ ਵਿਸ਼ਵਾਸ ਵਧਣ ਲੱਗਾ